ਜੇਕਰ ਗੱਲ ਕੀਤੀ ਜਾਵੇ ਧਾਰਮਿਕ ਮੌਕਿਆਂ 'ਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਉਣ ਦੀ ਤਾਂ ਮੈਂ ਸੱਚ ਦੱਸਾਂ ਤਾਂ ਮੈਨੂੰ ਹਾਲੇ ਤੱਕ ਅਜਿਹਾ ਮੌਕਾ ਨਹੀਂ ਮਿਲਿਆ ਜਾਂ ਅਜਿਹੀ ਦਿਲਚਸਪੀ ਮੇਰੇ ਮਨ ਦੇ ਅੰਦਰ ਨਹੀਂ ਜਾਗੀ ਕਿ ਮੈਂ ਇ ਇਹੋ ਜਿਹੀ ਕੋਈ ਮੂਰਤੀ ਬਣਾ ਪਾਵਾਂ ਅਤੇ ਮੈਨੂੰ ਲੱਗਦਾ ਕਿ ਉਸ ਦੇ ਲਈ ਜਿਹੜੀ ਮਿਹਨਤ ਹੈ ਉਹ ਬਹੁਤ ਜ਼ਿਆਦਾ ਕਰਨੀ ਪਵੇਗੀ ਅਤੇ ਉਸ ਦੇ ਨਾਲ ਹੀ ਬਹੁਤ ਜ਼ਿਆਦਾ ਐਕਸਪੀਰੀਅੰਸ ਅਤੇ ਨੌਲੇਜ ਦਾ ਹੋਣਾ ਵੀ ਜ਼ਰੂਰੀ ਹੈ ਪਰ ਇਸ ਤੋਂ ਇਲਾਵਾ ਮੈਂ ਇੱਕ ਵਾਰ ਦੁਸਹਿਰੇ ਦੇ ਮੌਕੇ ਰਾਵਣ ਦਾ ਬੁੱਤ ਜ਼ਰੂਰ ਤਿਆਰ ਕੀਤਾ ਸੀ ਜੋ ਸ਼ਾਇਦ ਮੂਰਤੀਆਂ ਦੇ ਅੰਦਰ ਤਾਂ ਨਹੀਂ ਆਉਂਦਾ ਪਰ ਮੈਨੂੰ ਲੱਗਦਾ ਵੀ ਉਹ ਇੱਕ ਐਸੀ ਚੀਜ਼ ਹੈ ਜਿਸਨੂੰ ਮੈਂ ਧਾਰਮਿਕ ਮੌਕੇ ਦੇ ਨਾਲ ਰਿਲੇਟ ਕਰ ਸਕਦੀ ਹਾਂ ਅਤੇ ਗੱਲ ਕੀਤੀ ਜਾਵੇ ਮੇਰੇ ਅਨੁਭਵ ਦੀ ਤਾਂ ਪਹਿਲਾਂ ਪਹਿਲਾਂ ਤਾਂ ਕਿਉਂਕਿ ਕੁਛ ਪਤਾ ਨਹੀਂ ਸੀ ਕਿਸ ਤਰੀਕੇ ਨਾਲ ਬਣਾਇਆ ਜਾਵੇਗਾ ਤਾਂ ਮੈਂ ਬਹੁਤ ਸਾਰੇ ਟਟੋਰੀਅਲਸ ਵੀ ਦੇਖੇ ਯੂਟੀਊਬ 'ਤੇ ਕਿ ਤੁਸੀਂ ਕਿਸ ਤਰੀਕੇ ਨਾਲ ਬਣਾ ਸਕਦੇ ਹੋ ਮੇਰਾ ਮਕਸਦ ਸੀਗਾ ਕਿ ਰਾਵਣ ਨੂੰ ਪਟਾਕਿਆਂ ਦੇ ਨਾਲ ਨਹੀਂ ਬਲਕਿ ਕਿਸੇ ਹੋਰ ਚੀਜ਼ ਨਾਲ ਭਰਿਆ ਜਾਵੇ ਜਿਵੇਂ ਕਿ ਕਿਸੇ ਤਰੀਕੇ ਦੀ ਕੋਈ ਗੁੱਡ ਫਰੈਗਰੈਂਸ ਦੇ ਨਾਲ ਜਾਂ ਕੋਈ ਕਲਰਫੁਲ ਤਰੀਕੇ ਦੀ ਚੀਜ਼ ਦੇ ਨਾਲ ਜੋ ਜ ਅੱਗ ਲੱਗਣ 'ਤੇ ਪੋਪ ਆਊਟ ਹੋਵੇ ਅਤੇ ਕੁਛ ਖੂਬਸੂਰਤ ਜਿਹਾ ਦਿਖੇ ਯਾਨੀ ਕਿ ਸ਼ੋਰ ਨਾ ਮੱਚੇ ਪਟਾਕਿਆਂ ਦੀ ਦੇ ਨਾਲ ਅਤੇ ਜਿਹੜਾ ਪਹਿਲਾ ਪਹਿਲਾ ਅਸੀ ਸਟਾਰਟਿੰਗ ਦੇ ਵਿੱਚ ਅਟੈਮਟ ਠੀਕ ਨਹੀਂ ਗਿਆ ਪਰ ਜਦ ਮੈਂ ਦੂਸਰੀ ਵਾਰ ਟਰਾਈ ਕੀਤਾ ਤਾਂ ਮੈਨੂੰ ਜਿਹੜੇ ਰਿਜ ਰਿਜਲਟਸ ਨੇ ਉਹ ਕਾਫੀ ਬੈਟਰ ਲੱਗੇ